ਬਜ਼ੁਰਗ ਲੋਕ ਕਈ ਤਰ੍ਹਾਂ ਦੀਆਂ ਗੇਮਾਂ ਖੇਡਣੀਆਂ ਪਸੰਦ ਕਰਦੇ ਹਨ ਜਿਵੇਂ ਕਿ ਆਪਾਂ ਗੱਲ ਕਰੀਏ ਮੈਂ ਦੱਸਣਾ ਚਾਹੁੰਦੀ ਹਾਂ ਕਿ ਬਜ਼ੁਰਗ ਲੋਕ ਜ਼ਿਆਦਾਤਰ ਕੈਰਮ ਬੋਰਡ ਤਾਸ਼ ਚੈੱਸ ਗੇਮ ਆਦਿ ਨੂੰ ਖੇਡਣਾ ਪਸੰਦ ਕਰਦੇ ਹਨ ਕਿਉਂਕਿ ਇਹ ਗੇਮਾਂ ਬੈਠ ਕੇ ਖੇਡਣ ਵਾਲੀਆਂ ਹਨ ਅਤੇ ਬਜ਼ੁਰਗ ਲੋਕ ਜ਼ਿਆਦਾਤਰ ਖੜੇ ਹੋ ਨਹੀਂ ਸਕਦੇ ਇਸ ਕਰਕੇ ਉਹ ਇਹ ਗੇਮਾਂ ਬੈਠ ਕੇ ਖੇਡਣਾ ਪਸੰਦ ਕਰਦੇ ਹਨ ਜਿਵੇਂ ਕਿ ਆਪਾਂ ਕੈਰਮ ਬੋਰਡ ਦੀ ਗੱਲ ਕਰੀਏ ਤਾਂ ਉਸ ਵਿੱਚ ਚਾਰ ਬਜ਼ੁਰਗ ਲੋਕ ਆਰਾਮ ਨਾਲ ਖੇਡ ਸਕਦੇ ਹਨ ਉਹ ਇਹ ਗੇਮਾਂ ਪਾਰਕ ਜਾਂ ਕਿਸੇ ਗਾਰਡਨ ਵਿੱਚ ਬੈਠ ਕੇ ਖੇਡਣਾ ਪਸੰਦ ਕਰਦੇ ਹਨ ਜਿਸ ਨਾਲ ਉਨ੍ਹਾਂ ਉਹ ਆਪਣੀਆਂ ਗੱਲਾਂ ਵੀ ਇੱਕ ਦੂਜੇ ਨੂੰ ਦੱਸਦੇ ਹਨ ਅਤੇ ਉਹਨਾਂ ਦੇ ਸਰੀਰ ਨੂੰ ਖੁੱਲ੍ਹੀ ਹਵਾ ਵੀ ਮਿਲਦੀ ਹੈ ਜਿਸ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹ ਆਪਣੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੀ ਇੱਕ ਦੂਜੇ ਨੂੰ ਦੱਸ ਕੇ ਉਹਨਾਂ ਉਸ ਦਾ ਸ਼ਲਿਊਸ਼ਨ ਨੂੰ ਲੱਭਦੇ ਹਨ ਜੇ ਆਪਾਂ ਗੱਲ ਕਰੀਏ ਬਜ਼ੁਰਗ ਲੋਕਾਂ ਦੀਆਂ ਗੇਮਾਂ ਦੀ ਤਾਂ ਉਹ ਇਹ ਗੇਮ ਤਾਂ ਖੇਡਦੇ ਹਨ ਤਾਂ ਕਿ ਉਹਨਾਂ ਦਾ ਜਿਹੜਾ ਸਰੀਰਕ ਸੰਤੁਲਨ ਤਾਂ ਕਿ ਵਧੀਆ ਰਹੇ